ਹੈਲੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਹਾਂਜੀ ਤੁਸੀਂ ਕੌਣ ਬੋਲਦੇ ਹੋ ਹਾਂਜੀ ਹਾਂ ਮਹਾਰਾਜਾ ਰਣਜੀਤ ਸਿੰਘ ਜਿੰਨਾਂ ਨੂੰ ਅਸੀਂ ਜਿਹੜਾ ਹੈ ਸ਼ੇਰੇ ਪੰਜਾਬ ਦੇ ਨਾਮ ਨਾਲ ਜਾਣਦੇ ਹਾਂ ਅਤੇ ਉਹ ਗੁਰੂ ਮਹਾਰਾਜ ਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਨਸਿੱਖ ਹੋਏ ਨੇ ਅਤੇ ਜਿਨ੍ਹਾਂ ਨੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੋ ਸਾਜੇ ਨਿਵਾਜੇ ਖਾਲਸਾ ਪੰਥ ਦੀ ਸੇਵਾਵਾਂ ਦੇ ਵਿੱਚ ਰਹਿ ਕੇ ਅਤੇ ਤਰੱਕੀ ਹਾਸਿਲ ਕੀਤੀ ਅਤੇ ਸਿੱਖਾਂ ਨੂੰ ਜਥੇਬੰਦ ਕੀਤਾ ਅਤੇ ਉਹਨਾਂ ਨੂੰ ਜਥੇਬੰਦ ਕਰਕੇ ਅਤੇ ਜਿਹੜੇ ਅਫਗਾਨ ਜਿਹੜੇ ਚੜ੍ਹ ਕੇ ਆਉਂਦੇ ਸੀ ਹਿੰਦੁਸਤਾਨ ਦੇ ਉੱਤੇ ਪੰਜਾਬ ਦੇ ਰਸਤੇ ਰਾਹੀਂ ਉਹ ਰਸਤਾ ਹਮੇਸ਼ਾ ਲਈ ਬੰਦ ਕਰ ਦਿੱਤਾ ਅਤੇ ਇੱਕ ਐਸਾ ਰਾਜ ਸਥਾਪਿਤ ਕੀਤਾ ਜਿਸਦੀ ਅੱਜ ਮਿਸਾਲ ਦੁਨੀਆਂ ਦੇ ਰਹੀ ਹੈ ਸੋ ਐਸੇ ਐਸੇ ਪ੍ਰਤਾਪੀ ਐਸੇ ਮਹਾਨ ਜੋ ਰਾਜਾ ਮਹਾਰਾਜਾ ਰਣਜੀਤ ਸਿੰਘ ਹੋਏ ਨੇ ਤੁਸੀਂ ਹੋਰ ਕਿਹਨਾਂ ਬਾਰੇ ਜਾਣਨਾ ਚਾਹੁੰਦੇ ਹੋ ਤਕਰੀਬਨ ਚਾਰ ਤੋਂ ਪੰਜ ਦਹਾਕੇ ਦੇ ਲਗਭਗ ਉਹਨਾਂ ਨੇ ਜਿਹੜਾ ਹੈ ਉਹ ਏਸ਼ੀਆ ਦੇ ਇਸ ਖਿੱਤੇ ਦੇ ਵਿੱਚ ਜਿਹੜਾ ਹੈ ਉਹ ਤੁਸੀਂ ਦੱਖਣੀ ਏਸ਼ੀਆ ਦਾ ਹਿੱਸਾ ਕਹਿ ਸਕਦੇ ਹੋ ਜਿਹਦੇ 'ਚ ਵੱਡਾ ਹਿੱਸਾ ਜਿਹੜਾ ਕਿ ਅਫਗਾਨਿਸਤਾਨ ਤੋਂ ਲੈ ਕੇ ਇਧਰ ਹਿੰਦੁਸਤਾਨ ਦਾ ਜੋ ਯਮੁਨਾ ਨਦੀ ਹੈ ਦਿੱਲੀ ਦੀਆਂ ਸਰਹੱਦਾਂ ਤੱਕ ਜਿਹੜਾ ਹੈ ਉਹ ਉਹਨਾਂ ਨੇ ਇਹ ਰਾਜ ਕਾਇਮ ਕੀਤਾ ਅਤੇ ਤਕਰੀਬਨ ਬਹੁਤ ਛੋਟੀ ਉਮਰ ਦੇ ਵਿੱਚ ਤੇਰ੍ਹਾਂ ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਸੱਸ ਹੈ ਉਹਦੀ ਹੈਲਪ ਦੇ ਨਾਲ ਉਹਦੀ ਮਦਦ ਦੇ ਨਾਲ ਸਦਾ ਕੌਰ ਜੀ ਦੀ ਹੈਲਪ ਦੇ ਨਾਲ ਮਦਦ ਨਾਲ ਉਹਨਾਂ ਨੇ ਲਾਹੌਰ 'ਤੇ ਕਬਜ਼ਾ ਕੀਤਾ ਅਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੀਆਂ ਸਿੱਖਾਂ ਦੀ ਜਿਹੜੀ ਰਾਜਨੀਤਿਕ ਸ਼ਕਤੀ ਹੈ ਉਹ ਵੰਡੀ ਹੋਈ ਸੀ ਬਾਰ੍ਹਾਂ ਮਿਸਲਾਂ ਦੇ ਵਿੱਚ ਅਤੇ ਉਹ ਮਿਸਲਾਂ ਨੂੰ ਇਕੱਠਾ ਕੀਤਾ ਅਤੇ ਇੱਕ ਰਾਜ ਕਾਇਮ ਕੀਤਾ ਜਿਹਦੀ ਮਿਸਾਲ ਅੱਜ ਦੁਨੀਆ ਦਿੰਦੀ ਹੈ ਆ ਦੇਖੋ ਇਤਿਹਾਸ ਦੇ ਵਿੱਚ ਉਹਨਾਂ ਦੇ ਰਾਜ ਬਾਰੇ ਬਹੁਤ ਸਾਰੀ ਕਿਤਾਬਾਂ ਮਿਲ ਜਾਂਦੀਆਂ ਨੇ ਪਰ ਜਿਹੜੀ ਡੋਕਟਰ ਗੰਡਾ ਸਿੰਘ ਜਿਹੜੇ ਮੌਜੂਦਾ ਸਮਿਆਂ ਦੇ ਵਿੱਚ ਹੋ ਚੁੱਕੇ ਨੇ ਜਿਹੜੇ ਪਿਛਲੀ ਸਦੀ ਦੇ ਵਿੱਚ ਉਹਨਾਂ ਨੇ ਉਹਦੇ ਉਹਨਾਂ ਦੇ ਉੱਤੇ ਇੱਕ ਅਧਿਕਾਰਕ ਤੌਰ 'ਤੇ ਕਾਫੀ ਸੋਹਣਾ ਕੰਮ ਕੀਤਾ ਅਤੇ ਉਹ ਉਹਨਾਂ ਦੀਆਂ ਜਿਹੜੀਆਂ ਰਚਨਾਵਾਂ ਤੁਸੀਂ ਪੜ੍ਹ ਸਕਦੇ ਹੋ ਉਸ ਤੋਂ ਇਲਾਵਾ ਹੋਰ ਵੀ ਵਿਸ਼ੇਸ਼ਤਾਵਾਂ ਮਿਲ ਜਾਂਦੀਆਂ ਨੇ ਪਰ ਉਹਨਾਂ ਨੇ ਜੋ ਤੱਥ ਭਰਪੂਰ ਜਾਣਕਾਰੀ ਜੋ ਉਹਨਾਂ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰੇ ਦਿੱਤੀ ਹੈ ਔਰ ਕਮਾਲ ਦੀ ਗੱਲ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਪਾਰਖੂ ਅੱਖ ਜਿਹੜੀ ਹੈ ਉਹ ਜਰਨੈਲਾਂ ਯੋਧਿਆਂ ਜਿਹੜੇ ਵੱਡੇ ਮਤਲਬ ਕਾਬਲ ਇਨਸਾਨ ਨੇ ਨਪੁੰਨ ਇਨਸਾਨ ਉਹਨਾ ਨੂੰ ਇੱਕ ਜਗ੍ਹਾ ਇਕੱਠਿਆ ਕਰਨਾ ਉਹਨਾਂ 'ਚ ਉਹਨਾਂ ਦਾ ਇੱਕ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਜਿਹੜਾ ਹੈ ਜਿਹਦੀ ਪਛਾਣ ਕਰਕੇ ਉਹਨਾਂ ਨੇ ਆਪਣੇ ਨਾਲ ਉਹਨੂੰ ਜਾਂ ਪੰਜਾਬ ਦੀ ਸੇਵਾਵਾਂ ਦੇ ਵਿੱਚ ਲਗਾਇਆ ਅਤੇ ਉਹ ਇਸ ਤਰ੍ਹਾਂ ਹੋਰ ਬਹੁਤ ਸਾਰੀਆਂ ਉਦਾਹਰਨਾਂ ਮਿਲ ਜਾਂਦੀਆਂ ਨੇ ਸੋ ਇਹ ਬਹੁਤ ਵੱਡੀ ਗੱਲ ਹੈ ਸੋ ਇਸ ਕਰਕੇ ਆਪਾਂ ਇੱਕ ਪੱਖ ਨਾਲ ਦੇਖਦੇ ਹੋਏ ਉਹਨਾਂ ਦੇ ਬਹੁਤ ਸਾਰੇ ਪਹਿਲੂ ਨੇ ਅਤੇ ਉਹ ਡੋਕਟਰ ਗੰਡਾ ਸਿੰਘ ਦੀ ਜਿਹੜੀ ਕਿਰਤ ਹੈਗੀ ਉਹਨਾਂ ਦੀ ਰਚਨਾਵਾਂ ਨੇ ਇਤਿਹਾਸਿਕ ਰਚਨਾਵਾਂ ਨੇ ਉਹਦੇ 'ਚ ਤੁਹਾਨੂੰ ਕਾਫੀ ਤੱਥ ਭਰਪੂਰ ਅਤੇ ਸਟੀਕ ਜਾਣਕਾਰੀ ਹਾਸਿਲ ਹੋ ਸਕਦੀ ਹੈ ਹਾਂਜੀ ਉਹਨਾਂ ਦਾ ਹੈ ਘਰ ਅਤੇ ਅਤੇ ਉਹਨਾਂ ਦੀ ਜਿਹੜੀ ਯਾਦਗਾਰ ਬਣੀ ਹੋਈ ਹੈ ਅਤੇ ਹੁਣ ਇਹ ਮੈਨੂੰ ਇੰਨੀ ਇਹਦੀ ਵਧੇਰੇ ਜਾਣਕਾਰੀ ਤਾਂ ਨਹੀਂ ਕਿਉਂਕਿ ਮੈਂ ਜਿਹੜਾ ਹੈ ਉਹ ਜਿਹੜਾ ਤੁਸੀਂ ਸਵਾਲ ਪਹਿਲਾਂ ਪੁੱਛਿਆ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰੇ ਉਹਨਾਂ ਦਾ ਕਿਲਾ ਹੋਰ ਅਸਥਾਨਾਂ ਬਾਰੇ ਜ਼ਿਆਦਾ ਜਾਣਕਾਰੀ ਹੈ ਭਾਈ ਵੀਰ ਸਿੰਘ ਦੇ ਘਰ ਮੈਂ ਕੁਝ ਕੁ ਵਾਰ ਗਿਆ ਹੋਇਆਂ ਚਾਰ ਪੰਜ ਵਾਰ ਗਿਆ ਹੋਇਆਂ ਅਤੇ ਉਹਨਾਂ ਦੀ ਬਹੁਤ ਡੂੰਘੀਆਂ ਪੈੜਾਂ ਨੇ ਸਾਡੇ ਸਾਹਿਤ ਦੇ ਉੱਤੇ ਪਿੱਛਲੀ ਸਦੀ ਦੀਆਂ ਅਤੇ ਲੇਕਿਨ ਮਹਾਰਾਜਾ ਰਣਜੀਤ ਸਿੰਘ ਬਾਰੇ ਕਿਉਂਕਿ ਅਸੀਂ ਬਹੁਤ ਸਾਰੇ ਅਖਬਾਰਾਂ ਦੇ ਵਿੱਚ ਜਾਂ ਵੱਖ ਵੱਖ ਮਾਧਿਅਮਾਂ ਰਾਹੀਂ ਕਾਫੀ ਕੁਝ ਜਾਣਕਾਰੀ ਪੜ੍ਹਦੇ ਰਹਿੰਦੇ ਹਾਂ ਸੋ ਉਹਨਾਂ ਬਾਰੇ ਥੋੜ੍ਹੀ ਜਾਣਕਾਰੀ ਕੰਪੈਟੀਵਲੀ ਜਾ ਕਹਿ ਲਓ ਥੋੜ੍ਹੀ ਜ਼ਿਆਦਾ ਰਹਿੰਦੀ ਹੈ ਸੋ ਜੀ ਜੀ ਜੀ ਸੋ ਆਪਾਂ ਹੋਰ ਮੌਕਿਆਂ 'ਤੇ ਵੀ ਉਹਨਾਂ ਇਹਨਾਂ ਇਹੋ ਜਿਹੀਆਂ ਹੋਰ ਸ਼ਖਸੀਅਤਾਂ ਬਾਰੇ ਗੱਲਬਾਤ ਕਰਦੇ ਰਹਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ